ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਸਥਾਨਕ ਰਾਸ਼ਟਰੀ ਸਮਾਗਮ ਹਨ ਅਤੇ ਇਹਨੂੰ ਇਹਦੇ 'ਚ ਭਾਗ ਲੈਣ ਲਈ ਬ ਸਕੂਲਾਂ ਦੇ ਬੱਚੇ ਆਉਂਦੇ ਹਨ ਅਤੇ ਇਹਨੂੰ ਵੇਖਣ ਲਈ ਬਹੁਤ ਸਾਰੇ ਲੋਕ ਆਉਂਦੇ ਹਨ